ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਮੀਨ ਕੌਰ ਹੈ ਮੈਂ ਘਨੌਰ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹਾਂ ਵੈਸੇ ਤਾਂ ਸਾਡਾ ਪਿੰਡ ਸ਼ਹਿਰ ਪੁਆਧ ਵਿੱਚ ਪੈਂਦਾ ਹੈ ਪਰ ਅਸੀਂ ਇੱਥੇ ਅਲੱਗ ਅਲੱਗ ਭਾਸ਼ਾ ਦੀ ਵਰਤੋਂ ਕਰਦੇ ਹਾਂ ਕੁਝ ਲੋਕ ਮੇਨ ਪੰਜਾਬੀ ਵੀ ਬੋਲਦੇ ਹਨ ਬਟ ਜ਼ਿਆਦਾਤਰ ਜਿਹੜੇ ਲੋਕ ਹ ਹਨ ਉਹ ਪੁਆਧੀ ਲੈਂਗੂਏਜ਼ ਹੀ ਬੋਲਦੇ ਹਨ ਜਿਵੇਂ ਕਿ ਅਸੀਂ ਗੱਲ ਕਰੀਏ ਕਿ ਸਾਡੇ ਇੱਥੇ ਦਾ ਮਸ਼ਹੂਰ ਭੋਜਨ ਪਕਵਾਨ ਕਿਹੜਾ ਹੈ ਸਾਡੇ ਪੰਜਾਬ 'ਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬਹੁਤ ਖਾਇਆ ਜਾਂਦਾ ਹੈ ਜੋ ਕਿ ਸਰਦੀਆਂ ਸਰਦੀਆਂ ਤਾਂ ਚੱਲਦਾ ਹੀ ਰਹਿੰਦਾ ਹੈ ਜੇ ਸਾਡੇ ਘਰ ਇੱਕ ਵਾਰ ਸਾਗ ਬਣ ਜੇ ਤਾਂ ਓਹ ਹਫ਼ਤਾ ਹਫ਼ਤਾ ਤੜਕਾ ਲਾ ਕੇ ਚੱਲਦਾ ਹੀ ਰਹਿੰਦਾ ਹੈ ਪਟਿਆਲੇ ਦਾ ਸਭ ਤੋਂ ਪ੍ਰਸਿੱਧ ਹੈ ਸਾਗ ਮੱਕੀ ਦੀ ਰੋਟੀ ਅਤੇ ਲੱਸੀ ਹੈ ਇਹ ਸਾਡੇ ਸੱਭਿਆਚਾਰ ਨੂੰ ਵੀ ਦਰਸਾਉਂਦਾ ਹੈ ਕਿਉਂਕਿ ਪੁਰਾਣੇ ਵੇਲਿਆਂ 'ਚ ਜਦੋਂ ਇੰਨੀਆਂ ਸਬਜ਼ੀਆਂ ਨਹੀਂ ਸਨ ਹੁੰਦੀਆਂ ਅਤੇ ਲੋਕ ਸ ਖੇਤਾਂ ਵਿੱਚੋ ਸਾਗ ਤੋੜ ਕੇ ਲਿਆਉਂਦੇ ਸਨ ਅਤੇ ਓਹੀ ਬਣਾਉਂਦੇ ਸਨ ਇਸ ਕਰਕੇ ਇਹ ਸਾਡੇ ਸੱਭਿਆਚਾਰ ਨਾਲ ਵੀ ਜੁੜਿਆ ਹੋਇਆ ਹੈ ਇਹ ਸਾਡੇ ਪਟਿਆਲੇ ਵਿੱਚ ਬਹੁਤ ਚੀਜ਼ਾਂ ਹਨ ਜੋ ਸਾਡੇ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ ਪਰ ਜਿਹੜਾ ਇੱਕ ਸਾਗ ਅਤੇ ਮੱਕੀ ਦੀ ਰੋਟੀ ਹੈ ਇਹ ਸਾਡੇ ਸੱਭਿਆਚਾਰ ਨਾਲ ਮੁੱਢ ਤੋਂ ਹੀ ਜੁੜਿਆ ਆ ਰਿਹਾ ਹੈ ਇਸ ਕਰਕੇ ਇਹ ਸ ਸਾਡਾ ਇੱਕ ਸੱਭਿਆਚਾਰਿਕ ਭੋਜਨ ਵੀ ਕਹਿ ਸਕਦੇ ਹਾਂ ਪ ਪਟਿਆਲੇ ਜ਼ਿਲ੍ਹੇ ਵਿੱਚ ਬਹੁਤ ਚੀਜ਼ਾਂ ਹਨ ਜੋ ਸਾਡਾ ਇਤਿਹਾਸ ਦਰਸਾਉਂਦੀਆ ਹਨ ਜਿਵੇਂ ਉੱਥੇ ਦੇ ਰਾਜਾ ਜੀ ਦਾ ਕਿਲ੍ਹਾ ਅੱਜ ਵੀ ਉੱਥੇ ਸਥਿਤ ਹੈ ਅਤੇ ਉੱਥੇ ਲੋਕ ਘੁੰਮਣ ਜਾਂਦੇ ਹਨ ਅਤੇ ਉੱਥੇ ਓਵੇਂ ਹੀ ਸਭ ਚੀਜ਼ਾਂ ਹਨ ਜੋ ਕੁਛ ਸਾਲ ਪਹਿਲਾਂ ਹੋਇਆ ਕਰਦੀਆਂ ਸਨ ਅਤੇ ਇਹ ਹੈ ਸਾਡੇ ਪਟਿਆਲੇ ਜ਼ਿਲ੍ਹੇ ਦੀਆਂ ਪ੍ਰਸਿੱਧ ਭੋਜਨ ਅਤੇ ਉਹਨਾਂ ਦਾ ਸੱਭਿਆਚਾਰ ਅਤੇ ਇਤਿਹਾਸ